ਹੈਲੋ ਹਾਂਜੀ ਜਸਵਿੰਦਰ ਡੀਲਰ ਬੋਲ਼ਦੇ ਹੋ ਭਾਅ ਜੀ ਮੈਂ ਨਾ ਇੱਥੇ ਤੁਹਾਡੇ ਕੋਲ਼ ਆਪਣਾ ਦਿੱਲੀ ਨੰਬਰ ਆਲੀ ਗੱਡੀ ਚਾਹੀਦੀ ਸੀ ਮੈਨੂੰ ਜੀ ਕੋਈ ਤੁਸੀਂ ਆਪਣਾ ਜਿੱਦਾਂ ਬਰੈਜਾ ਜਾਂ ਕਰੇਟਾ ਕੋਈ ਦੱਸ ਸਕਦੇ ਹੈ ਜੀ ਜੇ ਵੀਹ ਇੱਕੀ ਮਾਡਲ ਆਲੀ ਕੋਈ ਮਿਲ ਜਾਵੇ ਵਧੀਆ ਕੰਡੀਸ਼ਨ ਦੀ ਕਿੰਨੀ ਕੁ ਮਤਲਬ ਰੇਂਜ ਤੱਕ ਮਿਲਜੂਗੀ ਕਰੇਟਾ ਜਾਂ ਬਰੈਜਾ ਦੋਹਾਂ 'ਚੋਂ ਇੱਕ ਕੋਈ ਵੀ ਹੋ ਸਕਦੀ ਹੈ ਮਿਲ ਜੇ ਜੀ ਛੇ ਛੇ ਕੁ ਤੱਕ ਛੇ ਸਾਢੇ ਛੇ ਅੱਛਾ ਕਦੋਂ ਕੁ ਆਵਾ ਫਿਰ ਤੁਹਾਡੇ ਕੋਲ ਜਾਂ ਫਿਰ ਕਾਲ ਕਰੀਏ ਚਲੋ ਠੀਕ ਹੈ ਲੋਕੇਸ਼ਨ ਸੈਂਡ ਕਰ ਦਿਓ ਠੀਕ ਹੈ ਜੀ ਓਕੇ